ਮੈਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਰਹਿੰਦੀ ਹਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਈ ਇਤਿਹਾਸਿਕ ਸਥਾਨ ਹਨ ਜਿਵੇਂ ਅਜਾਇਬ ਘਰ ਅਤੇ ਆਰਟ ਗੈਲਰੀਆਂ ਹਨ ਅਤੇ ਇੱਥੇ ਦੇ ਕਿਲ੍ਹਾ ਚੌਂਕ ਵਿੱਚ ਰਾਜੇ ਮਹਾਰਾਜੇ ਦੀਆਂ ਪੇਂਟਿੰਗਾਂ ਆਦਿ ਕਲਾ ਕਲਾਵਾਂ ਬਹੁਤ ਬਹੁਤ ਹੀ ਜ਼ਿਆਦਾ ਸੰਭਾਲ ਕੇ ਉਹਨਾਂ ਦੀ ਵਿਰਾਸਤਾਂ ਨੂੰ ਰੱਖਿਆ ਹੋਇਆ ਹੈ ਅਤੇ ਉੱਥੇ ਮਹੀਨੇ ਦੇ ਵਿੱਚ ਹਫ਼ ਕਈ ਵਾਰ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ ਉਹਨਾਂ ਦੇ ਮਹਾਰਾਜੇ ਅਤੇ ਉਹਨਾਂ ਦੇ ਮਹਾਰਾਣੀਆਂ ਰਾਜੇ ਦੇ ਪਰ ਪੜਦਾਦੇ ਵਗੈਰਾ ਆਦਿ ਉਹਨਾਂ ਸਭ ਦੀਆਂ ਪੇਂਟਿੰਗ ਜੋ ਹੈ ਵਿਰਾਸਤ ਪੁਰਾਣੀਆਂ ਸੰਭਾਲ ਕੇ ਰੱਖੀਆਂ ਗਈਆਂ ਹਨ ਉਹਨਾਂ ਗੈਲਰੀਆਂ ਦੇ ਵਿੱਚ ਲੋਕਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਦਿਖਾਇਆ ਜਾਂਦਾ ਹੈ ਅਤੇ ਉਹ ਗੈਲਰੀਆਂ ਦੇ ਵਿੱਚ ਸੰਭਾਲ ਕੇ ਰੱਖੀਆਂ ਗਈਆਂ ਹਨ ਬਹੁਤ ਹੀ ਸੁਰੱਖਿਅਤ ਢੰ ਢੰਗ ਨਾਲ਼ ਉਹਨਾਂ ਜੋ ਕਿ ਵਿਰਾਸਤ ਦੇ ਨਾਲ਼ ਜੁੜੀਆਂ ਹਨ ਮਹਾਰਾਜੇ ਆਦਿ ਜਿੰਨੇ ਵੀ ਪਹਿਲਾਂ ਕਿਸ ਤਰ੍ਹਾਂ ਰਹਿੰਦੇ ਸਨ ਉਹਨਾਂ ਦੇ ਪੇਂਟਿੰਗ ਦੇ ਵਿੱਚ ਦਿਖਾਇਆ ਗਿਆ ਹੁੰਦਾ ਹੈ ਅਤੇ ਇਹ ਇਹ ਸਾਨੂੰ ਅੱਠ ਤੋਂ ਸਵੇਰੇ ਅੱਠ ਤੋਂ ਲੈ ਕੇ ਰਾਤ ਸ਼ਾਮ ਨੂੰ ਛੇ ਵਜੇ ਤੱਕ ਖੁੱਲ੍ਹਿਆ ਰਹਿੰਦਾ ਹੈ ਇਸ ਸਮੇਂ ਦੇ ਵਿੱਚ ਦੇ ਵਿੱਚ ਵਿੱਚ ਜੀ ਕਾਫ਼ੀ ਲੋਕ ਪ੍ਰਦਰਸ਼ਨ ਵੇਖਣ ਆਉਂਦੇ ਹਨ ਅਤੇ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਦਾ ਹੈ ਦੇਖ ਕੇ ਅਤੇ ਉਹਨਾਂ ਨੂੰ ਕਾਫ਼ੀ ਐਕਸਪਲੇਨ ਵੀ ਕੀਤਾ ਜਾਂਦਾ ਹੈ ਕਿ ਉਹ ਰਾਜੇ ਮਹਾਰਾਜਿਆਂ ਅਤੇ ਉਹਨਾਂ ਦੇ ਜੀਵਨ ਬਾਰੇ ਦੇ ਵਿੱਚ ਘਟਨਾਵਾਂ ਆਦਿ ਉਸ ਪੇਂਟਿੰਗ ਦੇ ਵਿੱਚ ਦਰਸਾਈਆਂ ਹੁੰਦੀਆਂ ਹਨ ਜੋ ਕਿ ਲੋਕਾਂ ਨੂੰ ਦੱਸੀਆਂ ਜਾਂਦੀਆਂ ਹਨ ਲੋਕਾਂ ਨੂੰ ਦੇਖ ਕੇ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਉਹ ਦੇਖ ਕੇ ਬਹੁਤ ਹੀ ਖੁਸ਼ ਵੀ ਹੁੰਦੇ ਹਨ